ਹਾਂਜੀ ਹਾਂ ਹਾਂਜੀ ਮੈਮ ਮੈਮ ਉਹਦੀ ਮੈ ਮਟੀਰੀਅਲ ਦੇ ਹਿਸਾਬ ਨਾਲ ਹੋਏਗੀ ਜਿੱਦਾਂ ਦੀ ਉਹਦੀ ਕੁਆਲਿਟੀ ਹੋਏਗੀ ਆਪਣੇ ਕੋਲੇ ਸਟਾਰਟਿੰਗ ਹੈ ਪੱਚੀ ਹਜ਼ਾਰ ਤੋਂ ਤੀਹ ਹਜ਼ਾਰ ਦੇ ਵਿੱਚ ਇੱਕ ਪੰਜਾਹ ਹਜ਼ਾਰ ਤੱਕ ਲਾਸਟ ਏ ਹਾਂਜੀ ਸਿੰਪਲ ਹਾਂਜੀ ਉਹ ਮੈਮ ਹੋਏਗਾ ਚਾਲ੍ਹੀ ਹਜ਼ਾਰ ਤੋਂ ਸਟਾਰਟਿੰਗ ਏ ਚਾਲ੍ਹੀ ਹਜ਼ਾਰ ਤੋਂ ਸੱਠ ਦੇ ਕਰੀਬ ਹੈ ਅਤੇ ਉਹਦੀਆਂ ਚੇਅਰ ਦੇ ਅਕੋਰਡਿੰਗ ਹੈ ਕੋਈ ਫਾਈਵ ਸੀਟਰ ਹੈ ਕੋਈ ਸੈਵਨ ਸੀਟਰ ਹੈ ਤੁਸੀਂ ਸੋਫਾ ਸੈਟ ਸਿੰਪਲ ਵੀ ਆ ਮੈਮ ਆਪਣੇ ਕੋਲ ਥੋੜ੍ਹਾ ਫੈਂਸੀ ਵੀ ਏ ਜਿਹੜਾ ਮਤਲਬ ਕਿ ਸੈਵਨ ਸੀਟਰ ਵੀ ਆ ਫਾਇਵ ਸੀਟਰ ਵੀ ਹੈ ਉਹ ਤੁਸੀਂ ਆਪਣੇ ਅਕੋਰਡਿੰਗ ਦੇਖ ਸਕਦੇ ਹੋ ਹੈ ਨਾ ਅਤੇ ਚੈੱਕ ਕਰ ਸਕਦੇ ਹੋ ਕੱਪਬੋਰਡ ਦੀ ਹੈਗੀ ਆ ਮੈਮ ਕੱਪਬੋਰਡ ਛੋਟੇ ਵੀ ਨੇ ਜਿੱਦਾਂ ਆਪਣੇ ਅਲਮਾਰੀ ਟਾਈਪ ਆ ਜਾਣਗੇ ਬੜੇ ਵਾਲੇ ਵੀ ਨੇ ਬੜੇ ਵਾਲੇ ਵੀ ਨੇ ਮੈਮ ਮੈਮ ਆਪਣੀ ਟਾਈਮਿੰਗ ਹੈਗੀ ਆ ਨੌ ਤੋਂ ਰਾਤੀ ਨੌ ਵਜੇ ਤੱਕ ਅਤੇ ਸੰਡੇ ਜਿਹੜੀ ਮਤਲਬ ਕਿ ਆਪਣੀ ਸ਼ੌਪ ਹੈ ਉਹ ਕਲੋਜ ਹੁੰਦੀ ਆ ਤੁਸੀਂ ਹੈ ਨਾ ਵੀ ਹਾ ਹਾਂਜੀ ਹਾਂਜੀ ਮੈਮ ਜੋ ਹੈ ਨਾ ਜੋ ਤੁਹਾਨੂੰ ਠੀਕ ਲੱਗਦਾ ਜਿਸ ਦਿਨ ਵੀ ਤੁਹਾਨੂੰ ਠੀਕ ਲੱਗਦਾ ਉਸ ਦਿਨ ਤੁਸੀਂ ਕਿਸੇ ਵੀ ਟਾਈਮ ਮੈਨੂੰ ਕਾਲ ਕਰ ਲੈਣਾ ਕਾਲ ਕਰਕੇ ਸ਼ੋਪ 'ਤੇ ਆ ਜਾਣਾ ਅਤੇ ਜੋ ਵੀ ਡਿਸਕਾਊਂਟ ਹੋਇਆ ਸੀ ਹੈ ਨਾ ਆਪਣੇ ਵੱਲੋਂ ਫੁੱਲ ਕਰਾਂਗੇ ਅਤੇ ਜੋ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਹੈ ਨਾ ਆਪਣਾ ਲੈ ਸਕਦੇ ਹੋ ਮੈਮ ਤੁਸੀਂ ਕਿੱਥੋਂ ਬੋਲ ਰਹੇ ਹੋ ਓਕੇ ਪਟਿਆਲਾ ਤੋਂ ਠੀਕ ਹੈ ਮੈਮ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਵਿਜਿਟ ਕਰ ਸਕਦੇ ਓਂ ਹੈ ਨਾ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਓਂ ਮੈਂ ਸ਼ੋਪ 'ਤੇ ਹੀ ਹੋਊ ਹਾਂਜੀ ਹਾਂਜੀ ਓਕੇ ਜੀ ਓਕੇ ਥੈਂਕ ਯੂ ਮੈਮ ਓਕੇ ਮੈਮ ਥੈਂਕ ਯੂ ਥੈਂਕ ਯੂ